ਬਾਲ ਮਜ਼ਦੂਰੀ ਨੂੰ ਰੋਕਣ ਲਈ ਪੰਜਾਬ ਵਿੱਚ ਪਿੰਡ ਪੱਧਰ 'ਤੇ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਿੱਚ ਇਹ ਐਲਾਨ ਕੀਤਾ ਗਿਆ ਹੈ ਕਿ ਕੋਈ ਵੀ ਬਾਲ ਮਜ਼ਦੂਰੀ ਨਹੀਂ ਕਰਵਾਏਗਾ ਜੇਕਰ ਕੋਈ ਅਜਿਹਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਇਸ ਨੂੰ ਨਿਗਰਾਨ ਕਰਨ ਲਈ ਕਮੇਟੀ ਬਣਾਈ ਗਈ ਹੈ ਇਸ ਨੂੰ ਨਿਗਰਾਨ ਕਰਨ ਵਾਲੀ ਕਮੇਟੀ ਦੇ ਮੈਂਬਰ ਪਿੰਡ ਵਿੱਚੋਂ ਹੀ ਕੁਝ ਸੂਝਵਾਨ ਲੋਕ ਹਨ ਇਹ ਵੇਖਦੇ ਹਨ ਕਿ ਕਿਤੇ ਬਾਲ ਮਜ਼ਦੂਰੀ ਤਾਂ ਨਹੀਂ ਹੋ ਰਹੀ ਜੇਕਰ ਕਿਤੇ ਹੋ ਰਹੀ ਹੈ ਤਾਂ ਉਸ ਨੂੰ ਰੋਕਿਆ ਜਾਂਦਾ ਹੈ ਥੋੜ੍ਹੇ ਸਮੇਂ ਪਹਿਲਾਂ ਹੀ ਸਾਡੇ ਪਿੰਡ ਵਿੱਚ ਅਜਿਹੀ ਘਟਨਾ ਵਾਪਰੀ ਕਿ ਇੱਕ ਘਰ ਵਿੱਚ ਤਿੰਨ ਬੱਚੇ ਸਨ ਜਿਹਨਾਂ ਦੀ ਉਮਰ ਚੌਦ੍ਹਾਂ ਸਾਲ ਤੋਂ ਘੱਟ ਸੀ ਅਤੇ ਉਹਨਾਂ ਦਾ ਪਿਤਾ ਸ਼ਰਾਬੀ ਸੀ ਜੋ ਕਿ ਉਹਨਾਂ ਤੋਂ ਜ਼ਬਰਨ ਕੰਮ ਕਰਵਾਉਣ ਕਰਵਾਉਂਦਾ ਸੀ ਉਹਨਾਂ ਨੂੰ ਇੱਟਾਂ ਵਾਲੇ ਭੱਠੇ 'ਤੇ ਇੱਟਾਂ ਕੱਢਣ ਲੈ ਕੇ ਜਾਂਦਾ ਸੀ ਅਤੇ ਬੱਚੇ ਇਸ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸਨ ਫਿਰ ਕਿਸੇ ਤਰ੍ਹਾਂ ਇਹ ਖਬਰ ਪ ਪਿੰਡ ਦੀ ਪੰਚਾਇਤ ਕਮੇਟੀ ਨੂੰ ਮਿਲੀ ਅਤੇ ਉਹਨਾਂ ਨੇ ਤੁਰੰਤ ਇਸ ਨੂੰ ਬੰਦ ਕਰਵਾਇਆ ਅਤੇ ਬੱਚਿਆਂ ਨੂੰ ਸਕੂਲ ਭੇਜਣ ਲਈ ਕਿਹਾ